ਕੁਝ ਦਿਨ ਪਹਿਲਾਂ ਅਸੀਂ ਇੱਕ ਮਨੋਰੰਜਨ ਪਾਰਕ ਵਿੱਚ ਪਰਿਵਾਰਿਕ ਸੈਰ ਕਰਨ ਲਈ ਟਿਕਟਾਂ ਬੁੱਕ ਕੀਤੀਆਂ ਸਨ ਪਰ ਖਰਾਬ ਮੌਸਮ ਨੇ ਸਾਡੀਆਂ ਯੋਜਨਾਵਾਂ ਨੂੰ ਕਮਜ਼ੋਰ ਕਰ ਦਿੱਤਾ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਬੇਲੋੜੇ ਖਰਚੇ ਤੋਂ ਬ ਬਚਣ ਲਈ ਸਾਡੀ ਬੁਕਿੰਗ ਰੱਦ ਕੀਤੀ ਜਾਵੇ ਜ ਅਸੀਂ ਜਦੋਂ ਪਾਰਕ ਵਿੱਚ ਘੁੰਮਣ ਗਏ ਤਾਂ ਅਚਾਨਕ ਬੱਦਲਵਾਈ ਹੋ ਗਈ ਜਿਸ ਨਾਲ ਬਾਰਿਸ਼ ਹੋ ਗਈ ਅਤੇ ਇਸ ਨਾਲ ਸਾਡਾ ਸਾਰਾ ਮਜ਼ਾ ਖਰਾਬ ਹੋ ਗਿਆ ਇਸ ਲਈ ਸਾਨੂੰ ਅਸੀਂ ਇਸ ਅਸੀਂ ਮਾਫ਼ੀ ਅਸੀਂ ਇਸ ਅਸੁਵਿਧਾ ਲਈ ਮਾਫ਼ੀ ਮੰਗਦੇ ਹਾਂ ਕਿ ਖਰਾਬ ਮ ਮੌਸਮ ਕਾਰਨ ਸ ਇਸ ਖਰਾਬ ਮੌਸਮ ਕਾਰਨ ਜੋ ਸਥਿਤੀ ਹੋਈ ਹੈ ਉਸ ਨਾਲ ਸਾਡੇ ਮਨੋਰੰਜਨ 'ਤੇ ਬਹੁਤ ਬੁਰਾ ਅਸਰ ਪਿਆ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਾਡੀ ਟਿਕਟਾਂ ਨੂੰ ਰੱਦ ਕੀ ਕਰਨ ਵਿੱਚ ਸਾਡੀ ਸਹਾਇਤਾ ਦਿੱਤੀ ਜਾਵੇ